ਤਕਨੋਲਜੀ ਨੇ ਵੈਸੇ ਗੱਲ ਕਰੀਏ ਕਲਾ ਉਦਯੋਗ ਦੇ ਵਿੱਚ ਕਾਫੀ ਤਰੱਕੀ ਕੀਤੀ ਹੈ ਜੇ ਗੱਲ ਕਰੀਏ ਤਾਂ ਜਿਵੇਂ ਕਿ ਮਿਊਜ਼ਿਕ ਇੰਡਸਟਰੀ ਦੇ ਵਿੱਚ ਨਵੇਂ ਸਾਜ਼ ਆਏ ਨੇ ਅਤੇ ਜੋ ਨਵੇਂ ਸਪੀਕਰ ਆਏ ਨੇ ਜਿਹੜੇ ਤੁਹਾਨੂੰ ਬਿਲਕੁਲ ਸਾਫ ਆਵਾਜ਼ ਦਿੰਦੇ ਨੇ ਅਤੇ ਜਿਹੜੇ ਕਲਾਕਾਰ ਨੇ ਉਹ ਆਪਣੇ ਜਿਹੜੇ ਨਵਾਂ ਗਾਣਾ ਕੋਈ ਵੀ ਕੱਢਣਾ ਚਾਹੁੰਦੇ ਨੇ ਉਹਨੂੰ ਰਿਕਾਰਡ ਕਰਕੇ ਯੂਟਿਊਬ ਦੇ ਉੱਤੇ ਜਾਂ ਇੰਸਟਾਗ੍ਰਾਮ ਦੇ ਉੱਤੇ ਉਹ ਭੇਜ ਸਕਦੇ ਨੇ ਅਤੇ ਆਪਣਾ ਫੋਲਵਿੰਗ ਵਧਵਾ ਸਕਦੇ ਨੇ